ਸਾਡੇ ਪਿੰਡਾਂ ਦੀ ਪਛਾਣ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਅੰਦਰ ਆਉਂਦੇ ਹੀ ਪਤਾ ਲੱਗ ਜਾਂਦੀ ਹੈ ਸ਼ੁਰੂਆਤ ਵਿੱਚ ਹੀ ਪਿੰਡ ਦੇ ਬੜੇ ਬੜੇ ਰੁੱਖ ਜੋ ਕਿ ਬਹੁਤ ਹੀ ਪੁਰਾਣੇ ਹਨ ਇਹਨਾਂ ਥੱਲੇ ਬਜ਼ੁਰਗ ਆਪਣਾ ਮਹਿਫਲ ਜਮਾ ਕੇ ਬਹਿੰਦੇ ਸੀ ਹੁਣ ਵੀ ਬਹਿੰਦੇ ਹਨ ਅਤੇ ਜਿਹੜੇ ਵੀ ਲੋਕ ਉਹਨਾਂ ਨੂੰ ਆਉਂਦੇ ਆ ਨਮਸਤੇ ਬੁਲਾ ਕੇ ਸਤਿ ਸ਼੍ਰੀ ਅਕਾਲ ਬੁਲਾ ਕੇ ਜਾਂਦੇ ਹਨ ਅਤੇ ਅੱਗੇ ਪਿੰਡ ਦੀਆਂ ਖੂਬਸੂਰਤ ਖੇਤ ਗਲੀਆਂ ਘਰ ਦੇ ਪੁਰਾਣੇ ਮਕਾਨ ਇਹ ਸਭ ਪੁਰਾਣੀ ਵਿਰਾਸਤ ਵਿ ਵਿਰਾਸਤ ਵਿੱਚ ਸ਼ਾਮਿਲ ਹਨ ਲੋਕ ਉੱਦਾਂ ਆਪਣੇ ਘਰਾਂ ਨੂੰ ਉਸੀ ਤਰ੍ਹਾਂ ਦਾ ਰੱਖ ਰੱਖ ਰਹੇ ਹਨ ਜੋ ਕਿ ਉਹਨਾਂ ਨੇ ਪੁਰਾਣੇ ਜ਼ਮਾਨੇ ਵਿੱਚ ਵੀ ਰੱਖਿਆ ਹੋਇਆ ਸੀ ਅਤੇ ਅੱਜ ਵੀ ਅੱਜ ਵੀ ਕੁੜੀਆਂ ਅੱਜ ਵੀ ਕੁੜੀਆਂ ਖੇਤਾਂ ਕੁੜੀਆਂ ਅਤੇ ਔਰਤਾਂ ਖੇਤਾਂ ਵਿੱਚ ਜਾ ਕੇ ਹਰ ਕੰਮ ਕਰਦੀਆਂ ਹਨ ਅਤੇ ਘਰ ਆ ਕੇ ਵੀ ਆਪਣੇ ਕੰਮ ਕਰਦੀਆਂ ਹਨ ਕੁੜੀਆਂ ਤਰ੍ਹਾਂ ਤਰ੍ਹਾਂ ਦੇ ਕੰਮ ਸਿੱਖ ਰਹੀਆਂ ਹਨ ਜਿਵੇਂ ਕਿ ਸਿਲਾਈ ਕਢਾਈ ਬੁਣਾਈ ਵਗੈਰਾ ਇਹ ਸਭ ਚੀਜ਼ਾਂ ਸਾਡੀ ਵਿਰਾਸਤ ਵਿੱਚ ਸ਼ਾਮਿਲ ਹਨ ਬਜ਼ੁਰਗ ਅਤੇ ਮਾਤਾਵਾਂ ਅੱਜ ਵੀ ਆਪਣਾ ਤਰ੍ਹਾਂ ਤਰ੍ਹਾਂ ਦੇ ਕੰਮ ਕਰ ਰਹੇ ਹਨ ਉਹਨਾਂ ਨੂੰ ਫਰੀ ਬੈਠਣਾ ਸਹੀ ਨਹੀਂ ਲੱਗਦਾ